ਹੈਲੋ ਹਾਂਜੀ ਬਾਈ ਜੀ ਮੈਂ ਐੱਕਸ ਵਾਈ ਜੈਡ ਸਿੰਘ ਬੋਲ ਰਿਹਾ ਹਾਂ ਮੈਨੂੰ ਤੁਹਾਡੇ ਦਫ਼ਤਰ 'ਚ ਇੱਕ ਪੱਤਰ ਪ੍ਰਾਪਤ ਹੋਇਆ ਸੀ ਜੀ ਜਿਸ ਵਿੱਚ ਤੁਸੀਂ ਕੁਛ ਅਪਡੇਸ਼ਨ ਲਈ ਮੈਨੂੰ ਮੰਗ ਕੀਤੀ ਹੈ ਅਤੇ ਮੈਂ ਉਹ ਨਵੀਆਂ ਅਪਡੇਸ਼ਨਸ ਕਰਵਾਉਣ ਲਈ ਫੋਨ ਕੀਤਾ ਸੀ ਤੁਹਾਨੂੰ ਹਾਂਜੀ ਕਿਉਂਕਿ ਹੁਣ ਮੇਰਾ ਇੱਥੋਂ ਥੋੜ੍ਹਾ ਜਿਹਾ ਪਤਾ ਬਦਲਿਆ ਹੈ ਇਸ ਕਰਕੇ ਮੈਂ ਨਵੀਂ ਅਪਡੇਸ਼ਨ ਕਰਵਾਉਣੀ ਚਾਹੁੰਦਾ ਹਾਂ ਹਾਂਜੀ ਇਹਦੇ ਵਿੱਚ ਮੇਰਾ ਆਧਾਰ ਕਾਰਡ ਨੰਬਰ ਤਾਂ ਉਹ ਹੀ ਪੁਰਾਣੇ ਵਾਲਾ ਹੀ ਹੈ ਪਤੇ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੈ ਉਹ ਪਤੇ ਦੇ ਵਿੱਚ ਤਬਦੀਲੀ ਜਿਹੜੀ ਹੈਗੀ ਹੈ ਉਹ ਮੈਂ ਤੁਹਾਨੂੰ ਦੱਸੀ ਜਾ ਰਿਹਾ ਹਾਂ ਉਹ ਤੁਸੀਂ ਕਿਰਪਾ ਕਰਕੇ ਦਰਜ ਕਰੀ ਜਾਵੇ ਹਾਂਜੀ ਪਤਾ ਬਦਲਨ ਦੇ ਨਾਲ ਆਪਣਾ ਖਾਤਾ ਨੰਬਰ ਵੀ ਬਦਲ ਗਿਆ ਹੈ ਹਾਂਜੀ ਖਾਤੇ ਨੰਬਰ ਨੂੰ ਵੀ ਅਪਡੇਟ ਕੀਤਾ ਜਾਵੇ ਜੀ ਹਾਂਜੀ ਹਾਂਜੀ ਅਤੇ ਹੋਰ ਮੇਰਾ ਅਧ ਪੈਨ ਕਾਰਡ ਨੰਬਰ ਸੇਮ ਹੀ ਹੈ ਹਾਂਜੀ ਅਤੇ ਹਾਂਜੀ ਪਤਾ ਜਿਹੜਾ ਮੈਂ ਹੁਣ ਤੁਹਾਨੂੰ ਲਿਖਾ ਏ ਰਿਹਾਂ ਉਹ ਵਾਲਾ ਪਤਾ ਦਰਜ ਕਰ ਦਿੱਤਾ ਜਾਵੇ ਜੀ ਹਾਂਜੀ ਹਾਂਜੀ ਹਾਂਜੀ ਫ਼ਸਲਾਂ ਦਾ ਜਿਹੜਾ ਬੀਮਾ ਹੈਗਾ ਉਹ ਮੈਂ ਕਰਵਾਇਆ ਹੋਇਆ ਫ਼ਸਲਾਂ ਦੇ ਵਿੱਚ ਵੀ ਇੱਕ ਦੋ ਖਾਤਾ ਨੰਬਰ ਚੇਂਜ ਕਰਨੇ ਹਨ ਜੋ ਕਿ ਆਪਾਂ ਹੋਰ ਵਾਹਣ ਐਤਕੀਂ ਲਿਆ ਸੀਗਾ ਹਾਂਜੀ ਉਹਦਾ ਖਾਤਾ ਨੰਬਰ ਆਪਣੇ ਖਾਤੇ 'ਚ ਪਾ ਦਿੱਤਾ ਜਾਵੇ ਓਕੇ ਜੀ ਹੋਰ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਹੋਵੇ ਜੀ ਚਲੋ ਹੁਣ ਇਹ ਜੇ ਆਪਣੀਆਂ ਜਿਹੜੀਆਂ ਤਬਦੀਲੀਆਂ ਤੁਸੀਂ ਕਰਨਾ ਚਾਹੁੰਦੇ ਸੀ ਹੋ ਗਈਆਂ ਜੀ ਚਲੋ ਸਰ ਬਹੁਤ ਬਹੁਤ ਧੰਨਵਾਦ ਸਰ ਜੀ ਬਹੁਤ ਬਹੁਤ ਧੰਨਵਾਦ